ਸਰਕਾਰ ਨੇ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਚ ਚਲਾਈਆਂ ਗਈਆਂ ਜਿਹਦੇ ਨਾਲ਼ ਲੋਕਾਂ ਨੂੰ ਬਹੁਤ ਲਾਭ ਮਿਲਦਾ ਹੈ ਜਿਵੇਂ ਆਯੁਸ਼ਮਾਨ ਜਿਹੜਾ ਕਾਰਡ ਬਣਦਾ ਉਹਦੇ ਨਾਲ਼ ਗਰੀਬ ਤੋਂ ਗਰੀਬ ਬੰਦਾ ਵੀ ਬਹੁਤ ਅੱਛਾ ਇਲਾਜ ਕਰਵਾ ਸਕਦਾ ਪੰਜ ਲੱਖ ਤੱਕ ਦਾ ਇਲਾਜ ਕਰਵਾ ਸਕਦੇ ਆ ਉਹਦੇ ਨਾਲ਼ ਜਦੋਂ ਘਰ 'ਚ ਕੋਈ ਬਿਮਾਰ ਹੋ ਜਾਂਦਾ ਫਿਰ ਅਚਾਨਕ ਤੋਂ ਐਨਾ ਖਰਚਾ ਆ ਜਾਂਦਾ ਜਿਵੇਂ ਗਰੀਬ ਬੰਦੇ ਨਹੀਂ ਇਲਾਜ ਕਰਵਾ ਸਕਦੇ ਉਸ ਸਕੀਮ ਨਾਲ਼ ਬਹੁਤ ਜ਼ਿਆਦਾ ਲਾਭ ਉਠਾ ਸਕਦੇ ਹੈ ਇਹਦੇ ਨਾਲ਼ ਬਹੁਤ ਹੀ ਚੰਗਾ ਇਲਾਜ ਹੁੰਦਾ ਹੈ ਬਹੁਤ ਲੋਕ ਇਸ ਤੋਂ ਲਾਭ ਉਠਾ ਰਹੇ ਹੈ ਜਿਵੇਂ ਹੋਰ ਇੱਕ ਸਕੀਮ ਚੱਲੀ ਹੈ ਜਿਵੇਂ ਆਟਾ ਦਾਲ ਦੀ ਹੋਈ ਜਿਵੇਂ ਬਹੁਤ ਜ਼ਿਆਦਾ ਗਰੀਬ ਲੋਕ ਆ ਜਿਹੜੇ ਉਹਨਾਂ ਨੂੰ ਆਪਣੀ ਹਰ ਟਾਈਮ ਉਹਨਾਂ ਨੂੰ ਆਪਣੀ ਰੋਟੀ ਦੀ ਚਿੰਤਾ ਰਹਿੰਦੀ ਹੈ ਤਾਂ ਇਸ ਸਕੀਮ ਨਾਲ਼ ਉਹਨਾਂ ਨੂੰ ਕਦੇ ਵੀ ਇਸ ਤਰ੍ਹਾਂ ਨਹੀਂ ਹੁੰਦਾ ਵੀ ਉਹ ਭੁੱਖੇ ਸੋ ਜਾਣਗੇ ਤਾਂ ਉਹਨਾਂ ਨੂੰ ਹਰ ਮਹੀਨੇ ਸਰਕਾਰ ਵੱਲ ਤੋਂ ਜਿਹੜਾ ਆਟਾ ਔਰ ਦਾਲ਼ ਦੀ ਸਕੀਮ ਦੇ ਤਹਿਤ ਉਹਨਾਂ ਨੂੰ ਆਟਾ ਔਰ ਦਾਲ਼ ਦੇਆ ਜਾਂਦ ਦਈ ਜਾਂਦੀ ਹੈ ਇਹਦੇ ਨਾਲ ਉਹਨਾਂ ਦੀ ਬਹੁਤ ਗਰੀਬਾਂ ਦੀ ਬਹੁਤ ਮਦਦ ਹੁੰਦੀ ਹੈ ਔਰ ਮੈਨੂੰ ਇਹ ਦੋਨੇ ਸਕੀਮਾਂ ਬਹੁਤ ਵਧੀਆ ਲੱਗੀਆਂ